ਜੀ ਬਿਲਕੁਲ ਮੈਂ ਚਿੱਤਰਕਾਰੀ ਦੇ ਵਿੱਚ ਜਿਹੜੀਆਂ ਕਲਾਸਾਂ ਹਨ ਉਹ ਲਈਆਂ ਹਨ ਮੈਂ ਸਿੱਖਿਆ ਲਈ ਹੈ ਚਿੱਤਰਕਾਰੀ ਦੀ ਅਤੇ ਮੇਰੇ ਗੁਰੂ ਸਨ ਕਮਲ ਕਾਂਤ ਜੀ ਕਮਲ ਕਾਂਤ ਸ਼ਰਮਾ ਜੀ ਅਤੇ ਸ਼ੁਰੂ ਦੇ ਵਿੱਚ ਮੈਂ ਇੱਦਾਂ ਹੀ ਉਨ੍ਹਾਂ ਤੋਂ ਸਿੱਖਿਆ ਲੈਣ ਤੋਂ ਪਹਿਲਾਂ ਮਤਲਬ ਮ ਗਿਆਰੀ ਗਿਆਰਵੀਂ ਜਮਾਤ ਦੇ ਵਿੱਚ ਮੈਂ ਐ ਐਜ ਅ ਇਨ੍ਹਾਂ ਨੂੰ ਇਹਨੂੰ ਵਿਸ਼ਾ ਆਪਣੇ ਕੋਰਸ ਦੇ ਵਿੱਚ ਲੈ ਲਿਆ ਸੀ ਚਿੱਤਰਕਾਰੀ ਨੂੰ ਅਤੇ ਉਸ ਤੋਂ ਪਹਿਲਾਂ ਮੈਂ ਇੰਝ ਹੀ ਅਪ ਕਿਸੇ ਦੇ ਪੰਨੇ ਦੇ ਉੱਤੇ ਕਿਸੇ ਚੀਜ਼ ਨੂੰ ਉਤਾਰਨਾ ਕਿਸੇ ਬਣੀ ਹੋਈ ਜਿਹੜੀ ਸਾਡੀ ਚਿੱਤਰਕਾਰੀ ਦੀ ਕਿਤਾਬ ਹੁੰਦੀ ਹੈ ਉੱਥੇ ਉਹਦੇ 'ਤੇ ਬਣੇ ਹੋਏ ਚਿੱਤਰਾਂ ਨੂੰ ਆਪ ਤੋਂ ਬਣਾਉਣ ਦੀ ਕੋਸ਼ਿਸ਼ ਕਰਨਾ ਤਾਂ ਮੇਰਾ ਹੱਥ ਉਸ ਦੇ ਵਿੱਚ ਕਾਫ਼ੀ ਸਾਫ਼ ਸੀ ਕਿ ਹੂ ਬ ਹੂ ਉਤਾਰਨ ਦਾ ਪਰ ਮੈਨੂੰ ਉਨ੍ਹਾਂ ਨੇ ਸਿਖਾਇਆ ਵੱਖ ਕਿਉਂਕਿ ਜਦੋਂ ਤੁਸੀਂ ਚੀਜ਼ਾਂ ਬਣਾਉਂਦੇ ਹੋ ਅਤੇ ਰੰਗਾਂ ਨੂੰ ਜਦੋਂ ਤੁਸੀਂ ਉਹਦੇ ਵਿੱਚ ਪੇਸ਼ ਕਰਦੇ ਹੋ ਤਾਂ ਮੈਨੂੰ ਉਨ੍ਹਾਂ ਨੇ ਮੇਰੇ ਜਿਹੜੇ ਗੁਰੂ ਸੀ ਉਨ੍ਹਾਂ ਨੇ ਉਨ੍ਹਾਂ ਨੇ ਸਿਖਾਇਆ ਕਿ ਕਿਸ ਤਰੀਕੇ ਦੇ ਨਾਲ ਆਪਾਂ ਵੱਖ ਵੱਖ ਰੰਗਾਂ ਨੂੰ ਰੰਗਾਂ ਦੇ ਨਾਲ ਕੰਮ ਕਰਦੇ ਹਾਂ ਅਤੇ ਹਰ ਰੰਗ ਨੂੰ ਤਰੀਕੇ ਨੂੰ ਕਰਨ ਦਾ ਬਹੁਤ ਅਲੱਗ ਤਰੀਕਾ ਹੁੰਦਾ ਹੈ ਜਿਵੇਂ ਕਿ ਮੈਂ ਉਦਾਹਰਨ ਵਜੋਂ ਦੱਸ ਸਕਦਾ ਹਾਂ ਕਿ ਅਕਸਰ ਜਦੋਂ ਜਿਹੜਾ ਵੀ ਕਿਤੇ ਗੂੜ੍ਹਾ ਰੰਗ ਆਪਾਂ ਨੂੰ ਦਿਖਦਾ ਹੈ ਤਾਂ ਆਪਾਂ ਉਹਦੇ ਵਿੱਚ ਕੀ ਹੈ ਕਾਲਾ ਰੰਗ ਭਰ ਦਿੰਦੇ ਹਾਂ ਵੀ ਕਿਸ ਕਿਤੇ ਕੋਈ ਗੂੜ੍ਹਾ ਦਿਖਿਆ ਤਾਂ ਠੀਕ ਹੈ ਇਹ ਕਾਲਾ ਜਿਹਾ ਲੱਗਦਾ ਕਾਲਾ ਕਰ ਦਿਓ ਵੀ ਮੈਨੂੰ ਸਾਡੇ ਗੁਰੂ ਨੇ ਸਿਖਾਇਆ ਕਿ ਕਦੇ ਵੀ ਜਿਹੜਾ ਕਾਲਾ ਰੰਗ ਹੈ ਉਹ ਤੁਹਾਡੀ ਪੂਰੀ ਮਿਹਨਤ ਬਰਬਾਦ ਕਰ ਸਕਦਾ ਹੈ ਕਿਉਂਕਿ ਤੁਸੀਂ ਕਾਲਾ ਰੰਗ ਕਿਤੇ ਕਰ ਦਿੰਦੇ ਹੋ ਨਾ ਤਾਂ ਉਸ ਨੂੰ ਸਹੀ ਕਰਨਾ ਬਹੁਤ ਮੁਸ਼ਕਲ ਹੈ ਤਾਂ ਇਸ ਲਈ ਹਮੇਸ਼ਾ ਜਿਹੜਾ ਰੰਗ ਤੁਸੀਂ ਕਰ ਰਹੇ ਹੋ ਅਗਰ ਮੰਨ ਲਓ ਕਿ ਤੁਸੀਂ ਕੋਈ ਅਸਮਾਨ ਬਣਾਉਣਾ ਹੈ ਉਹ ਦਿਨੇ ਨੀਲਾ ਹੁੰਦਾ ਹੈ ਤਾਂ ਜਦੋਂ ਰਾਤ ਹੋਵੇਗੀ ਤਾਂ ਉਹ ਨੀਲੇ ਤੋਂ ਹੀ ਗੂੜ੍ਹਾ ਹੋਵੇਗਾ ਜਿਹੜਾ ਕਾਲਾ ਰੰਗ ਹੈ ਉਹ ਕਦੇ ਵੀ ਖੁਦ ਦੇ ਵਿੱਚ ਇਸ ਤਰੀਕੇ ਨਾਲ ਨਹੀਂ ਰਹਿੰਦਾ ਉਹ ਹਮੇਸ਼ਾ ਜਿਹੜੇ ਪਹਿਲਾਂ ਵਾਲੇ ਰੰਗ ਹੁੰਦੇ ਹਨ ਉਨ੍ਹਾਂ ਨੂੰ ਹੀ ਹੋਰ ਗੂੜ੍ਹਾ ਕਰ ਦਿੰਦਾ ਹੈ ਤਾਂ ਨੀਲੇ ਦਾ ਜਿਹੜਾ ਸਭ ਤੋਂ ਗੂੜ੍ਹਾ ਰੰਗ ਹੁੰਦਾ ਹੈ ਨੀਲੇ ਦੇ ਵਿੱਚ ਉਸ ਉਸ ਨੂੰ ਜਦੋਂ ਤੁਸੀਂ ਕਰੋਂਗੇ ਤਾਂ ਤੁਸੀਂ ਦੇਖ ਪਾਉਂਗੇ ਕਿ ਹਾਂ ਜਿਸ ਤਰੀਕੇ ਨਾਲ ਰਾਤ ਆ ਕਿਸ ਥੋੜ੍ਹੀ ਰੋਸ਼ਨੀ ਥੋੜ੍ਹਾ ਅੰਧੇਰਾਪਨ ਉਹ ਆਪਾਂ ਉਸ ਤਰੀਕੇ ਨਾਲ ਦਰਸਾ ਸਕਦੇ ਹਾਂ ਤਾਂ ਇਹ ਹੀ ਮੇਰਾ ਤਜਰਬਾ ਹੈ ਜੋ ਕਹਿੰਦਾ ਹੈ ਕਿ ਸਿੱਖਿਆ ਲੈਣੀ ਵੀ ਬਹੁਤ ਜ਼ਰੂਰੀ ਹੈ ਜਿਸ ਨੂੰ ਤੁਸੀਂ ਜਿਸ ਦੀ ਕਲਾ ਨੂੰ ਪਸੰਦ ਕਰਦੇ ਹੋ ਉਸ ਤੋਂ ਉਸ ਦੇ ਕੋਲ ਜਾ ਕੇ ਬੈਠੋ ਬੈਠਣ ਦੇ ਨਾਲ ਦੇਖਣ ਦੇ ਨਾਲ ਹੀ ਜਿਹੜੀ ਇਹਦੀ ਸਿੱਖਿਆ ਹੈ ਉਹ ਆਉਂਦੀ ਹੈ ਤੁਹਾਨੂੰ ਕੋਈ ਦੱਸਦਾ ਨਹੀਂ ਹੈ ਬਸ ਤੁਸੀਂ ਦੇਖ ਦੇਖ ਕੇ ਸਿੱਖ ਜਾਂਦੇ ਹੋ